ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਰੈਲ ਮਾਜਰੇ ਤੋਂ ਮੈਂ ਤੁਹਾਡੀ ਸ਼ੋਪ ਤੋਂ ਇੱਕ ਸਵੈਟਰ ਦਾ ਔਡਰ ਕੀਤਾ ਸੀ ਜੋ ਕਿ ਮੈਨੂੰ ਕੱਲ੍ਹ ਮਿਲ ਗਿਆ ਉਹ ਸਵੈਟਰ ਜਦ ਮੈਂ ਖੋਲ੍ਹ ਕੇ ਦੇਖਿਆ ਤਾਂ ਇਹ ਉਹ ਨਹੀਂ ਸੀ ਜੋ ਮੈਂ ਔਡਰ ਕੀਤਾ ਹੈ ਇਹਦੇ ਕਲਰ ਜਿਸ ਦਾ ਕਿ ਪਹਿਲਾਂ ਰੈੱਡ ਸੀ ਮੈਂ ਔਡਰ ਕੀਤਾ ਇਹ ਔਰੇਂਜ ਕਲਰ ਦਾ ਆਇਆ ਹੈ ਇਹ ਕਾਫ਼ੀ ਲੂਜ਼ ਹੈ ਇਹ ਦੀ ਬੁਣਤੀ ਵੀ ਸਹੀ ਨਹੀਂ ਹੈ ਉਹ ਮੈਂ ਐਕਸ ਐੱਲ ਔਡਰ ਕੀਤਾ ਸੀ ਇਹ ਡਬਲ ਐਕਸ ਐੱਲ ਆ ਗਿਆ ਹੈ ਜੋ ਕਿ ਫਿੱਟ ਨਹੀਂ ਬੈਠ ਰਿਹਾ ਇਹ ਦੀ ਬੁਣਤੀ ਜਿਸ ਦਾ ਕੁੰਡੇ ਵੀ ਕਾਫ਼ੀ ਵੱਧ ਘੱਟ ਛੱਡੇ ਵੱਧ ਪਾਏ ਗਏ ਨੇ ਇਸ ਕਰਕੇ ਉਹਨੂੰ ਕਿਸੇ ਵੀ ਤਰ੍ਹਾਂ ਦੇ ਕਿਸੇ ਨੂੰ ਵੀ ਫਿੱਟ ਨਹੀਂ ਆ ਰਿਹਾ ਮੈਂ ਇਹ ਨੂੰ ਵਾਪਿਸ ਕਰਨਾ ਚਾਹੁੰਦੀ ਹਾਂ ਜੇ ਤਾਂ ਤੁਸੀਂ ਵਾਪਿਸ ਕਰਨਾ ਚਾਹੁੰਦੀ ਹਾਂ ਜੇ ਤਾਂ ਤੁਸੀਂ ਉਹਦੀ ਜਗ੍ਹਾ ਜੋ ਮੈਂ ਔਡਰ ਕੀਤਾ ਉਹ ਹੀ ਭੇਜਦੋ ਤਾਂ ਤੁਹਾਡੇ ਬਹੁਤ ਧੰਨਵਾਦ ਹੈ ਨਹੀਂ ਤਾਂ ਜਿਹੜਾ ਤੁਸੀਂ ਇਹਦੀ ਜਗ੍ਹਾ 'ਤੇ ਜਿਹੜੀ ਮੈਂ ਪੇਮੈਂਟ ਕੀਤੀ ਉਹ ਮੇਰੀ ਵਾਪਸ ਕਰ ਦਿਓ ਮੈਂ ਤੁਹਾਡੀ ਬਹੁਤ ਧੰਨਵਾਦ ਹੋਵਾਂਗੀ